ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਖੇਤਰ ਲੋਕਾਂ ਦੀ ਆਰਥਿਕ ਸਹਾਇਤਾ ਕਰਦੇ ਹਨ ਅਤੇ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਹਨ ਜਿਵੇਂ ਕਿ ਬੈਂਕਾਂ ਦੇ ਵਿੱਚ ਇੱਕ ਤਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੈਂਕ ਨੌਕਰੀਆਂ ਪ੍ਰਦਾਨ ਕਰਦਾ ਹੈ ਅਤੇ ਖਾਤਾ ਧਾਰਕ ਨੂੰ ਨਿਵੇਸ਼ ਕਰਨ ਵਾਲੇ ਖਾਤੇ ਖੁਲਵਾਉਂਦਾ ਹੈ ਜੀਰੋ ਬਿਆਜ ਦਰ 'ਤੇ ਖਾਤੇ ਖੁਲਵਾਉਂਦਾ ਹੈ ਔਰ ਘੱਟ ਕਿਸ਼ਤਾਂ 'ਤੇ ਲੋਨ ਦਿੰਦਾ ਹੈ ਘੱਟ ਵਿਆਜ ਤੇ ਲੋਨ ਪ੍ਰੋਵਾਈਡ ਕਰਦਾ ਹੈ ਬੈਂਕ ਅਤੇ ਇੱਦਾਂ ਹੀ ਲੋਕਾਂ ਦੀ ਬਹੁਤ ਸਹਾਇਤਾ ਹੁੰਦੀ ਹੈ ਅਤੇ ਬੀਮਾ ਖੇਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਮਾ ਖੇਤਰ ਦੇ ਵਿੱਚ ਅਸੀਂ ਬੱਚੇ ਤੋਂ ਲੈ ਕੇ ਵੱਡੇ ਤੱਕ ਦਾ ਹਰ ਇੱਕ ਕਿਸਮ ਦਾ ਆਪਾਂ ਬੀਮਾ ਕਰਵਾ ਸਕਦੇ ਹਾਂ ਜਿਵੇਂ ਸਿਹਤ ਦੇ ਵਿਕਾਸ ਦੇ ਵਿੱਚ ਆਪਾਂ ਕੋਈ ਆਪਣੀ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ ਉਹ ਵੀ ਬੀਮਾ ਖੇਤਰ ਦੇ ਵਿੱਚ ਹੁੰਦੀ ਹੈ ਅਤੇ ਸਰਕਾਰ ਤੋਂ ਆਪਾਂ ਬਹੁਤ ਇਸਦਾ ਫਾਇਦਾ ਲੈ ਸਕਦੇ ਹਾਂ ਅਤੇ ਬੈਂਕਾਂ ਦੇ ਕਾਰਨ ਹੀ ਬਹੁਤ ਲੋਕਾਂ ਨੂੰ ਤਾਂ ਆਪਣੀ ਮਾਲੀ ਹਾਲਤ ਸੁਧਾਰਨ ਦਾ ਮੌਕਾ ਮਿਲਿਆ ਹੈ ਲੋ ਜਿਵੇਂ ਪਿੰਡਾਂ ਦੇ ਵਿੱਚ ਲਗਾ ਲਓ ਘੱਟ ਆਮਦਨ ਵਾਲੇ ਲੋਕ ਵੀ ਆਪਣੇ ਛੋਟੀ ਛੋਟੀ ਬੱਚਤ ਕਰਕੇ ਬੈਂਕ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਉਹਨਾਂ ਦਾ ਫਾਇਦਾ ਹੁੰਦਾ ਕਿਉਂਕਿ ਘਰ ਵਿੱਚ ਤਾਂ ਜਿੰਨੇ ਵੀ ਦੇਖੋ ਹੋਣ ਪੈਸੇ ਉਨੇ ਹੀ ਥੋੜ੍ਹੇ ਹਨ ਔਰ ਛੋਟੀ ਛੋਟੀ ਆਪਣੀ ਲੋੜਾਂ ਪੂਰੀਆਂ ਕਰਨ ਦੇ ਲਈ ਆਪਾਂ ਨੂੰ ਵਰਤੋਂ ਕਰਨੀ ਹੀ ਪੈਂਦੀ ਹੈ ਲੇਕਿਨ ਬੈਂਕ ਇਹੋ ਜਿਹੀ ਚੀਜ਼ ਹੈ ਕਿ ਇੱਥੇ ਆਪਾਂ ਆਪਣਾ ਪੈਸਾ ਪੂਰਾ ਸੁਰੱਖਿਅਤ ਰੱਖ ਸਕਦੇ ਹਾਂ ਔਰ ਪੰਜ ਸਾਲ ਦੀ ਦਰ ਜਾਂ ਦਸ ਸਾਲ ਦੀ ਦਰ ਜਾਂ ਕਿਵੇਂ ਵੀ ਆਪਾਂ ਆਪਣਾ ਖਾਤਾ ਖੁਲਵਾ ਸਕਦੇ ਹਾਂ